ਸਾਡੇ ਘਰ ਵਿੱਚ ਬਹੁਤ ਹੀ ਵੱਡੀ ਬਾਗਬਾਨੀ ਹੈ ਕ ਕੁਝ ਕੁ ਅਸੀਂ ਜਿਹੜੇ ਪੌਦੇ ਆ ਉਹ ਵਿਹੜੇ 'ਚ ਲਗਾਏ ਅਤੇ ਕੁਝ ਕੁ ਛੱਤ ਉੱਪਰ ਬਹੁਤ ਸਾਰੇ ਮੈਂ ਫੁੱਲ ਜਿਹੜੇ ਆ ਉਹ ਵਿਹੜੇ 'ਚ ਰੱਖੇ ਆ ਜਿਵੇਂ ਕਿ ਗੁਲਾਬ ਦੇ ਫੁੱਲ ਗੈਂਦੇ ਦੇ ਫੁੱਲ ਉਹਨਾਂ ਨੂੰ ਮੈਂ ਗਮਲੇ ਵਿੱਚ ਸਜਾ ਕੇ ਰੱਖਿਆ ਹੈ ਜੋ ਕਿ ਬਹੁਤ ਹੀ ਸੋਹਣੇ ਲੱਗਦੇ ਹਨ ਸੂਰਜਮੁੱਖੀ ਦਾ ਫੁੱਲ ਅਤੇ ਗੁੱਟੇ ਦਾ ਫੁੱਲ ਉਹ ਵੀ ਵਿਹੜੇ ਵਿੱਚ ਲਗਾਇਆ ਹੈ ਬਹੁਤ ਸਾਰੀਆਂ ਵੇਲਾਂ ਜਿਹੜੀਆਂ ਕਿ ਛੱਤ ਉੱਪਰ ਚੜ੍ਹਾਈਆਂ ਗਈਆਂ ਹਨ ਜਿਹੜੀਆਂ ਕਿ ਬਹੁਤ ਹੀ ਸੋਹਣੀਆਂ ਵੀ ਲੱਗਦੀਆਂ ਹਨ ਅਤੇ ਉੱਥੇ ਬਹੁਤ ਹੀ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਵੀ ਹੁੰਦੀਆਂ ਹਨ ਜਿਵੇਂ ਕਿ ਤੋਰੀਆਂ ਦੀ ਸਬਜ਼ੀ ਭਿੰਡੀ ਤੋਰੀ ਅਤੇ ਉਕ ਛੱਤ ਉੱਪਰ ਥੋੜ੍ਹੇ ਜਿਹੇ ਕਰੇਲੇ ਵੀ ਲਗਾਏ ਹੋਏ ਹਨ ਵਿਹੜੇ ਵਿੱਚ ਕੁਝ ਕੁ ਫਲਾਂ ਦੇ ਬੂਟੇ ਵੀ ਲਗਾਏ ਹਨ ਜਿਵੇਂ ਕਿ ਅਮਰੂਦ ਦਾ ਬੂਟਾ ਕਿੰਨੂਆਂ ਦਾ ਅਤੇ ਜਾਮੁਣ ਦਾ ਬੂਟਾ ਵੀ ਲਗਾਇਆ ਗਿਆ ਹੈ ਨਾਲ ਹੀ ਕੋਰਨਰ 'ਤੇ ਅੰਗੂਰਾਂ ਦੀ ਵੇਲ ਵੀ ਚੜ੍ਹਾਈ ਗਈ ਹੈ ਛੱਤ ਉੱਪਰ ਗੱਲ ਕੀਤੀ ਜਾਵੇ ਤਾਂ ਕੋਰਨਰਾ 'ਤੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ ਜੋ ਕਿ ਘਰ ਵਿੱਚ ਸੋਹਣੇ ਵੀ ਲੱਗਦੇ ਹਨ ਅਤੇ ਉਹ ਅੋਕਸੀਜਨ ਦੇਣ ਵਿੱਚ ਵੀ ਕੰਮ ਆਉਂਦੇ ਹਨ ਇਹ ਬਹੁਤ ਹੀ ਲਾਭਦਾਇਕ ਹਨ ਮੈਂ ਬਹੁਤ ਹੀ ਤਰ੍ਹਾਂ ਤਰ੍ਹਾਂ ਦੀ ਬਾਗਬਾਨੀ ਕਰਨਾ ਪਸੰਦ ਕਰਦੀ ਹਨ ਕਰਦੀ ਹਾਂ ਅਤੇ ਬਹੁਤ ਹੀ ਤਰ੍ਹਾਂ ਦੇ ਬੂਟੇ ਵੀ ਲਗਾਏ ਹਨ